ਸਤਿ ਸ਼੍ਰੀ ਅਕਾਲ ਜੇ ਮੈਂ ਆਪਣੇ ਵੱਲੋਂ ਕਿਸੇ ਵਿਅਕਤੀ ਨੂੰ ਸਲਾਹ ਦੇਵਾਂ ਜੋ ਪਹਿਲੀ ਵਾਰ ਬੈਂਕ ਦੀ ਚੋਣ ਕਰ ਰਿਹਾ ਹੈ ਤਾਂ ਮੈਂ ਆਪਣੇ ਵੱਲੋਂ ਦੱਸਾਂਗੀ ਕਿ ਉਸ ਇਨਸਾਨ ਨੂੰ ਪਬਲਿਕ ਸੈਕਟਰ ਬੈਂਕ ਯਾਨੀ ਕਿ ਸਰਕਾਰੀ ਬੈਂਕਾਂ ਦੀ ਚੋਣ ਕਰਨੀ ਹੈ ਕਿਉਂਕਿ ਉਹ ਚੋਣ ਜ਼ਿਆਦਾ ਵਧੀਆ ਮੰਨੀ ਜਾਵੇਗੀ ਮੇਰੇ ਹਿਸਾਬ ਨਾਲ ਹਾਲਾਂਕਿ ਇਹ ਗੱਲ ਸਹੀ ਹੈ ਕਿ ਪ੍ਰਾਈਵੇਟ ਸੈਕਟਰ ਬੈਂਕ ਜਿਹੜੀ ਹੈਗੇ ਨੇ ਉਹਨਾਂ ਦੀ ਚੋਣ ਕਰਨਾ ਕਈ ਲੋਕਾਂ ਲਈ ਸੁਖਾਲਾ ਕਿਉਂਕਿ ਉਹਨਾਂ ਦੀ ਕਈ ਸੁਵਿਧਾਵਾਂ ਨੂੰ ਬੜੀ ਹੀ ਸੁਖਾਲੀਆਂ ਹਨ ਅਤੇ ਲੋਕਾਂ ਨੂੰ ਬਹੁਤ ਹੀ ਤਕਲੀਫ ਨਹੀਂ ਹੁੰਦੀ ਪਰ ਕਈ ਵਾਰ ਉਹਨਾਂ ਦੇ ਵਿੱਚ ਲੁਕਵੇਂ ਚਾਰਜਸ ਹੁੰਦੇ ਹਨ ਜੋ ਕਿ ਸਾਡੇ ਵਰਗੇ ਮੱਧ ਇਨਕਮ ਗਰੁੱਪ ਅਤੇ ਘੱਟ ਇੰਨਕਮ ਗਰੁੱਪ ਵਾਲੇ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਮੁਸ਼ਕਿਲ ਦਿੰਦੀ ਹੈ ਕਈ ਵਾਰ ਲੋਕ ਬੈਂਕ ਆਪਣੇ ਨਾਲ ਦੇ ਬੰਦਿਆਂ ਦੇ ਹਿਸਾਬ ਨਾਲ ਵੀ ਰੱਖ ਦਿੰਦੇ ਹਨ ਕਈ ਵਾਰ ਲੋਕ ਪਸੰਦ ਕਰਦੇ ਹਨ ਕਿ ਜਿੱਥੇ ਉਹਨਾਂ ਦੇ ਘਰਦਿਆਂ ਦਾ ਬੈਂਕ ਦਾ ਖਾਤਾ ਹੈ ਉਹ ਵੀ ਉੱਥੇ ਹੀ ਬੈਂਕ ਦਾ ਖਾਤਾ ਖੁੱਲ੍ਹਵਾਉਣਾ ਪਸੰਦ ਕਰਦੇ ਹਨ ਪਰ ਕਈ ਵਾਰ ਇਹ ਇੱਕ ਨਵੇਂ ਬੈਂਕ ਦੇ ਵਿੱਚ ਖਾਤਾ ਖੁਲ੍ਹਵਾਉਣਾ ਵੀ ਲੋਕਾਂ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਸਾਬਿਤ ਹੋਇਆ ਮੈਨੂੰ ਇਹ ਲੱਗਦਾ ਕਿ ਲੋਕਾਂ ਨੂੰ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਘੱਟੋ ਘੱਟ ਇੱਕ ਤੋਂ ਜ਼ਿਆਦਾ ਬੈਂਕ ਦੇ ਵਿੱਚ ਖਾਤਾ ਖੁਲ੍ਹਵਾ ਕੇ ਰੱਖਣਾ ਚਾਹੀਦਾ ਜੋ ਕਿ ਉਹਨਾਂ ਦੀ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋ ਸਕਦਾ